ਹੈਲੋ ਹੈਲੋ ਹਾਂ ਹਾਂ ਸੀਮਾ ਸੀਮਾ ਬੋਲਦੀ ਐ ਹਾਂ ਤੇ ਅੱਜ ਕੀ ਨਾਮ ਹੈਗੇ ਵੀ ਤੂੰ ਥੋੜਾ ਜਲਦੀ ਆ ਜਾਏਗੀ ਕੱਲ ਮੈਂ ਕੱਲ ਨੂੰ ਕੋਈ ਗੈਸਟ ਆਉਣੇ ਹੈਗੇ ਘਰੇ ਤੇ ਵੀ ਥੋੜਾ ਬਹੁਤਾ ਕੰਮ ਵੀ ਵੱਧ ਜਾਊਗਾ ਚਲੋ ਬੱਚੇ ਦੀ ਕੇਅਰ ਤਾਂ ਹੁੰਦੀ ਹੋਈ ਹੋ ਹੀ ਜਾਂਦੀ ਐ ਉਹਦੀ ਕੋਈ ਟੈਂਸ਼ਨ ਨਹੀਂ ਵੀ ਕੱਲ ਇਦਾਂ ਸ਼ਕਲ ਸ਼ਾਮ ਤੱਕ ਗੈਸਟ ਆਣੇ ਹੈਗੇ ਆ ਤੇ ਘਰੇ ਵੀ ਥੋੜੀ ਸਾਫ ਸਫਾਈ ਦਾ ਵੀ ਹੈਗਾ ਥੋੜੀ ਬਹੁਤੀ ਹੈਲਪ ਹੋ ਜਾਗੀ ਮੇਰੀ ਹਾਂ ਵੀ ਜੇ ਤੂੰ ਓਕੇ ਠੀਕ ਐ ਨਹੀਂ ਉਹ ਤਾਂ ਕੋਈ ਗੱਲ ਨਹੀਂ ਵੀ ਉਹ ਤੋਂ ਉਹ ਤੋਂ ਕੀ ਨਾਮ ਹੈਗਾ ਉਹ ਤਾਂ ਤੂੰ ਘੰਟੇ ਘੰਟੇ ਅੱਧੇ ਘੰਟੇ ਚ ਕਰ ਹੀ ਲਏਗੀ ਵੀ ਉਸ ਤੋਂ ਬਾਅਦ ਥੋੜਾ ਐਕਸਟਰਾ ਟਾਈਮ ਲਗਾ ਦੀ ਕੋਈ ਗੱਲ ਨਹੀਂ ਵੀ ਹੁਣ ਮੇਰੀ ਵੀ ਮਜਬੂਰੀ ਆ ਹੁਣ ਮੈਨੂੰ ਬਾਹਰ ਜਾਣਾ ਪੈਂਦਾ ਜਿਵੇਂ ਹਨਾ ਵੀ ਪਿੱਛੋਂ ਬੱਚਾ ਤਾਂ ਸੰਭਾਲਦੀ ਏ ਥੋੜਾ ਜਿਹਾ ਬਸ ਅੱਧਾ ਪੋਣਾ ਘੰਟਾ ਜਿਵੇਂ ਤੂੰ ਵੱਧ ਕੱਢ ਲਵੇ ਕੋਈ ਗੱਲ ਨਹੀਂ ਇਨੀ ਆਪਾਂ ਸੈਟਿੰਗ ਕਰ ਲਵਾਂਗੇ ਹਾਂ ਹਾਂ ਵੀ ਗੱਲ ਦੇਖ ਲੇ ਬਾਕੀ ਕੀ ਨਾਮ ਹੈ ਇਸ ਚੀਜ਼ ਦੀ ਨਾ ਟੈਂਸ਼ਨ ਲਈ ਵੀ ਜਿਵੇਂ ਜੇ ਕੋਈ ਟਾਈਮ ਵੀ ਵੱਧ ਲੱਗੂਗਾ ਵੀ ਉਹ ਐਕਸਟਰਾ ਪੈਮਟ ਨੂੰ ਮਿਲ ਜਾਊਗੀ ਉਸਦੀ ਵੀ ਨਾ ਤੂੰ ਟੈਂਸ਼ਨ ਲਈ ਬਾਕੀ ਹਾਂ ਵੀ ਇਦਾਂ ਹੀ ਵੀ ਕੀ ਨਾਮ ਹੈਗਾ ਵੀ ਛੱਤ ਦੀ ਸਫਾਈ ਕਰਨ ਵਾਲੀਆਂ ਹੁਣ ਜੇ ਨੀਚੇ ਕੀ ਨਾਮ ਹੈਗੇ ਕੰਮ ਕਰਦੀ ਆਂ ਤਾਂ ਫਿਰ ਛੱਤ ਵਾਲੀ ਸਫਾਈ ਰਹਿ ਜਾਂਦੀ ਐ ਕਿਉਂ ਤੈਨੂੰ ਪਤਾ ਤਾਂ ਹੈ ਬੱਚੇ ਛੋਟੇ ਆ ਤੇ ਫਿਰ ਉਹਨਾਂ ਦੀ ਉਹਨਾਂ ਦਾ ਵੀ ਧਿਆਨ ਰੱਖਣਾ ਪੈਂਦਾ ਹਨਾ ਫੇਰ ਇਦਾਂ ਇਸ ਕਰਕੇ ਮੈਨੂੰ ਗਾ ਵੀ ਆਪਾਂ ਬੱਚੇ ਵੀ ਚਲੋ ਛੱਤ ਵੀ ਗੱਲ ਹੈ ਤਾਂ ਛੁੱਟੀ ਐ ਬੱਚਿਆਂ ਦੀ ਪੀ ਟੀ ਐਮ ਐ ਉਸ ਤੋਂ ਬਾਅਦ 'ਚ ਫਰੀ ਐ ਬੱਚਿਆਂ ਨੇ ਤਾਂ ਜਾਣਾ ਹੀ ਨਹੀਂ ਗਾ ਹਾਂ ਤੇ ਫਿਰ ਦੇਖ ਲਾਂਗੇ ਨਾ ਵੀ ਫਿਰ ਦੇਖ ਲਾਂਗੇ ਬੱਚੇ ਵੀ ਚਲੋ ਥੋੜੀ ਬਹੁਤੀ ਬੱਚੇ ਦਾ ਧਿਆਨ ਹੋ ਜਾਊਗਾ ਉੱਪਰ ਹੀ ਦੋਨੋਂ ਜਣੀਆਂ ਹੋਵਾਂਗੇ ਤਾਂ ਧਿਆਨ ਰੱਖ ਲਾਂਗੇ ਕਈ ਵਾਰੀ ਹੁਣ ਜਿਵੇਂ ਕੀ ਨਾਮ ਹੈਗੇ ਆ ਉੱਪਰ ਨੀਚੇ ਚੜਨਾ ਵੀ ਪੈਂਦਾ ਸਫਾਈ ਕਰਨਾ ਵਾਸਤੇ ਵੀ ਉੱਪਰ ਕੀ ਨਾਮ ਹੈਗੇ ਹੁਣ ਪਹਿਲੋਂ ਕਿੰਨਾ ਟਾਈਮ ਹੋ ਗਿਆ ਸਫਾਈ ਕੀਤੀ ਨਹੀਂ ਗੀ ਤੇ ਫਿਰ ਹੁਣ ਨੀਚੇ ਅਰੇਂਜਮੈਂਟ ਵੀ ਨਹੀਂ ਹੋਣਾ ਗੈਸਟ ਆਣਗੇ ਰਾਤ ਵੀ ਰੁਕਣਗੇ ਹਨਾ ਤੇ ਇਦਾਂ ਇਦਾਂ ਹੀ ਏ ਫਿਰ ਤਾਂ ਕਰਕੇ ਮੈਨੂੰ ਮਜਬੂਰੀ ਐ ਬਸ ਹੋਰ ਨਹੀਂ ਕੋਈ ਗੱਲ ਹਾਂ ਬੱਸ ਤੁੂੰ ਏਨਾ ਹੀ ਹਾਂ ਕਿਉਂਕਿ ਮੈਂ ਅੱਗੇ ਕਾਫੀ ਟਾਈਮ ਤੋਂ ਉਹਨਾਂ ਨੂੰ ਮਨਾ ਕਰਦੀ ਆ ਰਹੀ ਫਿਰ ਉਹਨਾਂ ਨੇ ਕੱਲ ਪੱਕਾ ਫਾਈਨਲ ਕਰ ਲਿਆ ਵੀ ਕੱਲ ਸ਼ਾਮ ਤੱਕ ਆ ਜਾਣਗੇ ਤੇ ਐਹ ਨਾ ਉਹਨਾਂ ਨੇ ਦੂਰੋਂ ਨਾ ਫਿਰ ਆਪਾਂ ਵਾਰ ਵਾਰ ਮਨਾ ਵੀ ਨਹੀਂ ਨਾ ਕਰ ਸਕਦੇ ਹਾਂ ਹਾਂ ਜੇ ਕੋਈ ਗੱਲ ਨਹੀਂ ਵੀ ਚੱਲ ਕੀ ਨਾਮ ਹੈਗੇ ਵੀ ਤੂੰ ਥੋੜਾ ਜਿਹਾ ਐਕਸਟਰਾ ਟਾਈਮ ਕੱਢ ਲਈ ਠੀਕ ਐ ਹਾਂ ਬਾਕੀ ਕੀ ਨਾਮ ਹੈਗੇ ਆ ਬਾਕੀ ਆਉਣਾ ਤਾਂ ਹੈਗਾ ਹੀ ਜਦੋਂ ਦੇਖ ਲਾਂਗੇ ਮੈਨੂੰ ਐ ਵੀ ਅੱਗੇ ਨਾ ਮੇਰਾ ਕੰਮ ਛੱਡ ਕੇ ਵਿੱਚ ਦੀ ਜਾਗੀ ਇਸ ਕਰਕੇ ਮੈਂ ਤਾਂ ਪਹਿਲਾਂ ਫੋਨ ਕੀਤਾ ਮੈਂ ਕਿਹਾ ਵੀ ਚੱਲ ਤੈਨੂੰ ਪਹਿਲਾਂ ਪਤਾ ਹੋਵੇ ਮੈਨੂੰ ਅੱਜ ਕੀ ਨਾਮ ਹੈਗਾ ਵੀ ਉੱਥੇ ਟਾਈਮ ਵੱਧ ਲੱਗ ਜੂਗਾ ਹੋਰ ਨਹੀਂ ਕੋਈ ਗੱਲ ਹਾਂ ਠੀਕ ਨਹੀਂ ਨਹੀਂ ਜ਼ਿਆਦਾ ਰਾਤ ਨਹੀਂ ਹੁੰਦੀ ਜ਼ਿਆਦਾ ਰਾਤ ਨਹੀਂ ਹੁੰਦੀ ਕੋਈ ਗੱਲ ਨਹੀਂ ਹਾਂ ਠੀਕ ਠੀਕ ਓਕੇ